ਸਿੱਖਣ ਵਿੱਚ ਆਪਣਾ ਦਈਏ ਕਿ ਜਿੰਨਾ ਟਾਈਮ ਹੋ ਸਕੀਏ ਅਸੀਂ ਗਾਉਣ ਨੂੰ ਟਾਈਮ ਦਿੰਦੇ ਹਾਂ ਅਤੇ ਬਹੁਤ ਵਧੀਆ ਲੱਗਦਾ ਇਹ ਅਤੇ ਗੀਤ ਸਿੱਖਣ ਲਈ ਮੈਨੂੰ ਇਕੱਲੇ ਬਹਿ ਕੇ ਗੀਤ ਸਿੱਖਣਾ ਵਧੀਆ ਲੱਗਦਾ ਏ ਕਿ ਕਿਸੇ ਸਾਹਮਣੇ ਗੀਤ ਥੋੜ੍ਹਾ ਔਖਾ ਲੱਗਦਾ ਸਿੱਖਣਾ ਇਕੱਲੇ ਬਹਿ ਕੇ ਗੀਤ ਸਿੱਖਦੇ ਹਾਂ ਬਹੁਤ ਵਧੀਆ ਲੱਗਦਾ ਏ ਅਤੇ ਟਾਈਮ ਵੀ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਟਾਈਮ ਫਿਰ ਵੀ ਜਿੰਨਾ ਹੋ ਸਕੇ ਅਸੀਂ ਦਿੰਦੇ ਹਾਂ ਅਤੇ ਗੀਤ ਸਿੱਖਣ ਲਈ ਫਿਰ ਵੀ ਘੱਟ ਤੋਂ ਘੱਟ ਵੀ ਦੋ ਤਿੰਨ ਘੰਟੇ ਆਪਣੇ ਆਪ ਨੂੰ ਦਿੰਦੇ ਹਾਂ ਕਿ ਅਸੀਂ ਚੰਗੀ ਤਰ੍ਹਾਂ ਗੀਤ ਸਿੱਖ ਸਕੀਏ ਅਸੀਂ ਇਕੱਲੇ ਬਹਿ ਕੇ ਗੀਤ ਸਿੱਖਦੇ ਹਾਂ ਕਿ ਸਾਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਅਤੇ ਅਸੀਂ ਵਧੀਆ ਢੰਗ ਨਾਲ ਆਪਣੇ ਆਪ 'ਤੇ ਪੂਰਾ ਕੋਨਸਨਟ੍ਰੇਨ ਕਰਕੇ ਅਤੇ ਗੀਤ ਸਿੱਖ ਸਕੀਏ ਅਤੇ ਸਾਨੂੰ ਕੋਈ ਵੀ ਦਿੱਕਤ ਨਾ ਆਵੇ ਕੋਈ ਵੀ ਪਰੇਸ਼ਾਨੀ ਨਾ ਆਵੇ ਇਸ ਕਰਕੇ ਇਕੱਲੇ ਬਹਿ ਕੇ ਵੱਧ ਤੋਂ ਵੱਧ ਟਾਈਮ ਦੇ ਕੇ ਗੀਤ ਸਿੱਖਣਾ ਪਸੰਦ ਕਰਦੇ ਹਾਂ ਅਤੇ ਵਧੀਆ ਵੀ ਲੱਗਦਾ ਹੈ ਕਿ ਬਿਨਾਂ ਡਰੇ ਬੇਫਿਕਰ ਹੋ ਕੇ ਅਸੀਂ ਗੀਤ ਸਿੱਖ ਸਕਦੇ ਹਾਂ ਇਕੱਲੇ ਬਹਿ ਕੇ ਇਸ ਕਰਕੇ ਮੈਂ ਇਕੱਲੇ ਬਹਿ ਕੇ ਗੀਤ ਸਿੱਖਣਾ ਪਸੰਦ ਕਰਦੀ ਹਾਂ ਅਤੇ ਮੈਨੂੰ ਵਧੀਆ ਵੀ ਲੱਗਦਾ ਇਹ ਕਿ ਵੱਧ ਤੋਂ ਵੱਧ ਟਾਈਮ ਦੇ ਕੇ ਆਪਣਾ ਬੇਫਿਕਰ ਹੋ ਕੇ ਅਸੀਂ ਵਧੀਆ ਢੰਗ ਨਾਲ ਗੀਤ ਸਿੱਖ ਸਕਦੇ ਹਾਂ